ਹਾਂਜੀ ਜਦੋਂ ਮੈਂ ਵੱਖ ਵੱਖ ਥਾਵਾਂ 'ਤੇ ਘੁੰਮਣ ਗਈ ਤਾਂ ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜੇ ਮੈਂ ਗੱਲ ਕਰਾਂ ਸੜਕਾਂ ਦੀ ਤਾਂ ਸੜਕਾਂ ਜਦੋਂ ਅਸੀਂ ਗੱਡੀ 'ਤੇ ਸਫ਼ਰ ਕਰ ਰਹੇ ਸੀ ਤਾਂ ਸੜਕਾਂ ਬਹੁਤ ਸਾਰੀਆਂ ਜਗ੍ਹਾ ਤੋਂ ਟੁੱਟੀਆਂ ਫੁੱਟੀਆ ਸਨ ਜਿਸ ਕਰਕੇ ਕਿ ਸਾਡਾ ਬਹੁਤ ਸਾਰਾ ਟਾਈਮ ਵੀ ਖ਼ਰਾਬ ਹੁੰਦਾ ਹੈ ਅਤੇ ਸਾਨੂੰ ਸਫ਼ਰ ਕਰਨ ਵਿੱਚ ਵੀ ਮੁਸ਼ਕਿਲ ਆਉਂਦੀ ਹੈ ਜੇ ਮੈਂ ਗੱਲ ਕਰਾਂ ਬੱਸਾਂ ਵੀ ਮੈਂ ਕੋਈ ਥਾਵਾਂ 'ਤੇ ਬੱਸਾਂ 'ਤੇ ਵੀ ਸਫ਼ਰ ਕੀਤਾ ਹੈ ਬੱਸਾਂ ਵਿੱਚ ਸਫ਼ਰ ਕਰਦੇ ਸਮੇਂ ਬਹੁਤ ਵਾਰ ਇਹ ਹੁੰਦਾ ਹੈ ਕਿ ਸਾਨੂੰ ਬਸ ਭਰੀ ਹੋਣ ਕਾਰਣ ਸੀਟ ਨਹੀਂ ਮਿਲਦੀ ਅਤੇ ਬਹੁਤ ਦੂਰ ਦੂਰ ਤੱਕ ਸਾਨੂੰ ਖੜ੍ਹੇ ਹੋ ਕੇ ਜਾਣਾ ਪੈਂਦਾ ਹੈ ਬੱਸਾਂ ਵਿੱਚ ਪੈਰ ਰੱਖਣ ਲਈ ਵੀ ਥਾਂ ਨਹੀਂ ਹੁੰਦੀ ਜੇ ਮੈਂ ਗੱਲ ਕਰਾਂ ਟ੍ਰੇਨ ਦੀ ਤਾਂ ਜੇ ਹਾਂ ਮੈਂ ਬਹੁਤ ਸਾਰੀਆਂ ਜਗ੍ਹਾ 'ਤੇ ਟ੍ਰੇਨ 'ਤੇ ਵੀ ਸਫ਼ਰ ਕੀਤਾ ਹੈ ਟ੍ਰੇਨ ਵਿੱਚ ਵੀ ਜ਼ਿਆਦਾਤਰ ਲੇਬਰ ਕਲਾਸ ਹੋਣ ਕਰਕੇ ਜਿਹੜਾ ਹੈ ਕਿ ਮਤਲਬ ਟ੍ਰੇਨ ਦੀ ਜਿਹੜੀ ਸਾਫ਼ ਸਫ਼ਾਈ ਨਹੀਂ ਹੁੰਦੀ ਗੀ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਲੋਕ ਸਿਗਰੇਟ ਤੰਬਾਕੂ ਆਹ ਚੀਜ਼ਾਂ ਦਾ ਪ੍ਰਯੋਗ ਕਰਦੇ ਹਨ ਜਿਸ ਕਰਕੇ ਕੀ ਹੈ ਉਹਨਾਂ ਦੀ ਜੋ ਸਾਨੂੰ ਆ ਉਹ ਬਦਬੂ ਆਉਂਦੀ ਰਹਿੰਦੀ ਹੈ ਜੇ ਮੈਂ ਗੱਲ ਕਰਾਂ ਆਟੋ ਦੀ ਤਾਂ ਜਦੋਂ ਅਸੀਂ ਆਟੋ 'ਤੇ ਸਫ਼ਰ ਕਰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਆਟੋ ਵਾਲੇ ਥੋੜ੍ਹੇ ਜਗ੍ਹਾ 'ਤੇ ਦੂਰ ਜਾਣ ਲਈ ਹੀ ਬਹੁਤ ਸਾਰੇ ਪੈਸੇ ਲੈ ਲੈਂਦੇ ਹਨ ਤਾਂ ਆਟੋ ਵਾਲਿਆਂ ਦਾ ਜੋ ਵਿਵਹਾਰ ਹੈ ਜੋ ਤਰੀਕਾ ਉਹਨਾਂ ਦਾ ਗੱਲ ਕਰਨ ਦਾ ਉਹ ਵੀ ਸਹੀ ਨਹੀਂ ਹੁੰਦਾ ਬਹੁਤ ਵਾਰ ਸਾਨੂੰ ਇਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ